ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਮਦਦ ਕਰ ਸਕਦੇ ਹਾਂ ਅਸੀਂ ਤੁਹਾਡੀ

ਹਾਂਜੀ ਹਾਂਜੀ

ਹਾਂਜੀ ਮੈਮ ਪਹਿਲਾਂ ਤਾਂ ਤੁਸੀਂ ਆਪਣਾ ਬਜਟ ਦੱਸ ਦਿਉ ਕਿੰਨੇ ਦੇ ਕਿੰਨੇ ਰੇਂਜ ਵਿੱਚ ਅਸੀਂ ਮਤਲਬ ਤੁਹਾਡੀ ਜਿਹੜੀ ਵੀ ਨੀਡ ਅਕੋਡਿੰਗ ਹੀ ਆਪਾਂ ਡੈਕੋਰੇਸ਼ਨ ਕੈਟਰਿੰਗ ਵਗੈਰਾ ਕਰ ਸਕਦੇ ਹਾਂ ਜਿਵੇਂ ਕਿ ਬ ਬਜਟ ਦੇ ਅਕੋਡਿੰਗ ਨਹੀਂ ਇਹ ਤੁਹਾਡੀ ਨੀਡ ਅਕੋਡਿੰਗ ਆਪਾਂ ਦੇਖਾਂਗੇ ਹੈਲੋ ਹਣ ਮਿਨੀਮਮ ਪੈਕਜ ਔਲ ਓਵਰ ਮਤਲਬ ਸਾਰਾ ਮਿਲਾ ਕੇ ਇਕੱਲੀ ਡੈਕੋਰੇਸ਼ਨ ਦਾ ਅਸੀਂ ਫਿਫਟੀ ਥਾਊਸੈਂਡ ਲੈਂਦੇ ਹਾਂ ਹਾਂਜੀ ਹਾ ਹਾਂਜੀ ਹਾਂਜੀ ਹਾਂਜੀ ਮੈਕਸੀਮਮ ਦੋ ਲੱਖ ਤੱਕ ਚਲੀ ਜਾਂਦੀ ਹੈ ਮੈਮ ਰੇਂਜ ਹਾਂਜੀ ਹਾਂਜੀ ਹਾਂਜੀ ਨਹੀਂ ਮੈਮ ਇਹ ਇੱਕ ਦਿਨ ਦੀ ਪੈਕਜ ਦੀ ਗੱਲ ਕਰ ਰਹੀ ਹਾਂ ਮਤਲਬ ਉਹਦੇ ਵਿੱਚ ਵੀ ਅਸੀਂ ਪ੍ਰੋਪਰ ਡੈਕੋਰੇਸ਼ਨ ਹੈ ਜਿੱਦਾਂ ਮਹਿੰਦੀ ਦਾ ਫੰਕਸ਼ਨ ਹੋ ਗਿਆ ਉਸ 'ਤੇ ਅਸੀਂ ਡੈਕੋਰੇਸ਼ਨ ਕਰਦਾਂਗਾ ਗੇ

ਨਹੀਂ ਹੋਏਗਾ ਹਾਂਜੀ ਖਾਣਾ ਨਹੀਂ ਉਹ ਤੁਹਾਡੇ ਉੱਪਰ ਹੈ ਅਗਰ ਮਤਲਬ ਜਿਹੜੇ ਤੁਸੀਂ ਮਤਲਬ ਕੁਕਿੰਗ ਕਰਨ ਵਾਲੇ ਆਪਣੇ ਖੁਦ ਦੇ ਉਹ ਕਰਨੇ ਨੇ ਜਾਂ ਮਤਲਬ ਸਾਡੇ ਹੀ ਇੱਧਰੋਂ ਕੋਈ ਆਏਗਾ ਉਸਦੇ ਅਕੋਡਿੰਗ ਬ ਹਾਂਜੀ ਬਜਟ ਦੇ ਵਿੱਚ ਉਸ ਤਰ੍ਹਾਂ ਫਰਕ ਪੈ ਜਾਵੇਗਾ ਹਾਂਜੀ ਹਾਂਜੀ ਮੈਮ ਸਾਰੇ ਤਰ੍ਹਾਂ ਦੀ ਡੈਕੋਰੇਸ਼ਨ ਅਸੀਂ ਕਰਦੇ ਹਾਂ ਪਲਾਸਟਿਕ ਡੈਕੋਰੇਸ਼ਨ ਕੁਛ ਪਲਾਸਟਿਕ ਆਈਟਮ ਹੁੰਦੇ ਆ ਕੁਛ ਰੀਅਲ ਜਿਹੜੇ ਫਲਾਵਰ ਹੁੰਦੇ ਉਹਨਾਂ ਦੀ ਡੈਕੋਰੇਸ਼ਨ ਹੁੰਦੀ ਹੈ ਹਾਂ ਹਾਂਜੀ ਹਾਂਜੀ ਹਾਂਜੀ ਜ਼ਿਆਦਾ ਜਾਣਕਾਰੀ ਲੈਣੀ ਹੋਈ ਮੈਡਮ ਤੁਸੀਂ ਆਫਿਸ 'ਚ ਗੱਲ ਕਰ ਲਉ ਜੀ ਠੀਕ ਹੈ ਜੀ ਓਕ